ਅੱਜ ਕੱਲ ਦੀਆਂ ਸਰਕਾਰੀ ਸਕੀਮਾਂ ਇੰਨੀਆਂ ਵਧੀਆ ਹੋ ਗਈਆਂ ਹਨ ਕਿ ਸਾਡੀਆਂ ਸਰਕਾਰੀ ਸੇਵਾਵਾਂ ਨੇ ਸਾਡੇ ਪ੍ਰਾਈਵੇਟ ਸੇਵਾਵਾਂ ਨੂੰ ਪਛਾੜ ਦਿੱਤਾ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਦਵਾਈਆਂ ਇੰਨੀਆਂ ਦਵਾਈਆਂ ਅਤੇ ਰੋਗ ਇੰਨੇ ਵੱਧ ਗਏ ਹਨ ਕਿ ਆਪਣੀ ਹੈ ਹੈਲਥ ਅਤੇ ਸਰ ਦਵਾਈਆਂ ਦੇ ਉੱਤੇ ਪੈਸੇ ਲਾਉਣੇ ਬਹੁਤ ਹੀ ਮੁਸ਼ਕਲ ਹੋ ਗਏ ਹਨ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੋਕ ਇੰਨਾ ਨਹੀਂ ਜਾ ਸਕਦੇ ਜਿੰਨਾ ਤੁਸੀਂ ਆਪਣੇ ਸਰਕਾਰੀ ਹਸਪਤਾਲਾਂ ਨਿੱਜੀ ਹਸਪਤਾਲਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਚੈੱਕ ਕਰਵਾ ਸਕਦੇ ਹੋ ਅਤੇ ਉਹਦੀ ਦਵਾਈਆਂ ਲੈ ਸਕਦੇ ਹੋ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਇੰਨੇ ਚੰਗੇ ਤਰੀਕੇ ਨਾਲ ਸਰਕਾਰੀ ਹਸਪਤਾਲ ਬਣਾ ਦਿੱਤੇ ਗਏ ਹਨ ਕਿ ਜਿਹਦੇ ਕਰਕੇ ਉਹ ਪੁਰਾਣੇ ਗਲਤੀਆਂ ਵੀ ਘੱਟ ਹੋ ਗਈਆਂ ਹਨ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜਾ ਵੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਲਾਜ ਕਰਵਾਉਂਦਾ ਹੈ ਜਿੰਨੀ ਵੀ ਫੀਸ ਹੋਏ ਉਹ ਸਾਰੀ ਸਰਕਾਰ ਹੀ ਕਰਦੀ ਪਈ ਹੈ ਦਸ ਹਜ਼ਾਰ ਤੋਂ ਵੱਧ ਦੇ ਖਰਚੇ ਉਹ ਆਪ ਸਰਕਾਰ ਹੀ ਚੁੱਕ ਰਹੀ ਹੈ ਛੋਟੇ ਤੋਂ ਛੋਟੇ ਦੀ ਛੋਟੀ ਬਿਮਾਰੀ ਦੀ ਵੀ ਦਵਾਈ ਦਾ ਖਰਚਾ ਉਹ ਆਪ ਚੱਕ ਰਹੀ ਹੈ ਜੇ ਅਸੀਂ ਪ੍ਰਾਈਵੇਟ ਹਸਪਤਾਲ ਦੀ ਗੱਲ ਕਰੀਏ ਪ੍ਰਾਈਵੇਟ ਹਸਪਤਾਲ ਦੇ ਵਿੱਚ ਡੇਢ ਤੋਂ ਤਿੰਨ ਲੱਖ ਡੇਢ ਤੋਂ ਦਸ ਲੱਖ ਦਾ ਤਾਂ ਉਵੇਂ ਹੀ ਖਰਚਾ ਹੋ ਜਾਂਦਾ ਹੈ ਜੇ ਕੋਈ ਆਪਣਾ ਪੂਰੀ ਤਰੀਕੇ ਨਾਲ ਇਲਾਜ ਕਰਵਾਉਣ ਜਾਵੇ ਲੇਕਿਨ ਸਰਕਾਰੀ ਹਸਪਤਾਲ ਦੇ ਵਿੱਚ ਆਪਾਂ ਜੇ ਛੋਟੀ ਵੱਡੀ ਤੋਂ ਵੱਡੀ ਪਰੇਸ਼ਾਨੀ ਜਾਂ ਬਿਮਾਰੀ ਵੀ ਲੈ ਕੇ ਚੱਲ ਜਈਏ ਉਹਦੀ ਉਹਦਾ ਵੀ ਘੱਟ ਪੈਸਿਆਂ ਵਿੱਚ ਸਮਾਧਾਨ ਹੋ ਜਾਂਦਾ ਹੈ ਅਤੇ ਇਲਾਜ ਵੀ ਬੜਾ ਵਧੀਆ ਹੋ ਗਿਆ ਹੈ ਦਵਾਈਆਂ 'ਤੇ ਵੀ ਓਰਿਜਨਲ ਹਨ ਅਤੇ ਸਾਨੂੰ ਕੋਈ ਵੀ ਤਰੀਕੇ ਦੀ ਗਲਤੀ ਨਹੀਂ ਲੱਭ